ਸਾਡੇ ਜੀਵਨ ਵਿੱਚ ਬੈਂਕਿੰਗ ਅਤੇ ਬੀਮਾ ਬਹੁਤ ਹੀ ਮਹੱਤਵਪੂਰਨ ਹਿੱਸਾ ਰੱਖਦੇ ਹਨ ਅਗਰ ਅਸੀਂ ਆਪਣੇ ਪੈਸੇ ਨੂੰ ਕਿਤੇ ਵੀ ਲਗਾਉਣਾ ਹੈ ਜਾਂ ਆਪਣੇ ਪੈਸੇ ਨੂੰ ਵਧਾਉਣਾ ਹੈ ਤਾਂ ਬੀਮਾ ਇਸ ਲਈ ਬਹੁਤ ਹੀ ਵਧੀਆ ਜਗ੍ਹਾ ਹੈ ਅਗਰ ਸਾਡੇ ਕੋਲ ਪੈਸੇ ਪਏ ਹਨ ਅਤੇ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਉਸਨੂੰ ਕਿੱਥੇ ਲਗਾਈਏ ਤਾਂ ਬੀਮਾ ਇਸ ਦਾ ਸਭ ਤੋਂ ਵਧੀਆ ਤਰੀਕਾ ਹੈ ਅਗਰ ਆਪਾਂ ਆਪਣੇ ਪੈਸੇ ਜਮ੍ਹਾਂ ਕਰਾਉਣਾ ਚਾਹੁੰਦੇ ਹਾਂ ਉਸ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ ਤਾਂ ਬੈਂਕਿੰਗ ਵੀ ਬਹੁਤ ਵਧੀਆ ਚੀਜ਼ ਹੈ ਇਸ ਕਰਕੇ ਇਹ ਦੋਨੋਂ ਚੀਜ਼ਾਂ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਹਿੱਸਾ ਰੱਖਦੀਆਂ ਹਨ ਇਸ ਕਰਕੇ ਇਸ ਨੇ ਸਾਡੇ ਨਿੱਜੀ ਵਿੱਤ ਦਾ ਪ੍ਰਬੰਧ ਬਹੁਤ ਹੀ ਵਧੀਆ ਤਰ੍ਹਾਂ ਨਾਲ ਕੀਤਾ ਹੋਇਆ ਹੈ ਇਸ ਕਰਕੇ ਇਹਨਾਂ ਦੋਨਾਂ ਦੀ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਤਾ ਹੈ ਧੰਨਵਾਦ